ਹੈਲੋ ਓਲਾ ਐਪ ਕੈਬ ਤੋਂ ਗੱਲ ਕਰ ਰਹੇ ਜੀ ਅਸੀਂ ਜਾਣਾ ਸੀ ਆਪਣੇ ਅੰਮ੍ਰਿਤਸਰ ਸਾਹਿਬ ਦਰਸ਼ਨਾਂ ਲਈ ਅਤੇ ਉਹਦੇ ਲਈ ਆਪਾਂ ਨੂੰ ਇੱਕ ਕਾਰ ਮੁਹੱਈਆ ਕਰਵਾ ਸਕਦੇ ਹੋ ਤੁਸੀਂ ਆਪਣੀਆਂ ਸਵਾਰੀਆਂ ਹੋਣਗੀਆਂ ਘੱਟੋ ਘੱਟ ਬਾਰ੍ਹਾਂ ਜਾਣੇ ਮਤਲਬ ਟਵੈਲਵ ਸੀਟਡ ਹੋਣੀ ਚਾਹੀਦੀ ਗੱਡੀ ਅਤੇ ਉਸ ਦੇ ਲਈ ਸਾਨੂੰ ਕੀ ਪੇ ਕਰਨਾ ਪਊਗਾ ਕਿੰਨਾ ਖਰਚਾ ਸਾਨੂੰ ਦੇਣਾ ਪੈਣਾ ਅਤੇ ਉਹਦੇ ਵਿੱਚ ਤੁਸੀਂ ਕੀ ਕੀ ਪੈਕੇਜ ਦਿੰਦੇ ਹੋ ਜਿਵੇਂ ਕਿ ਰਸਤੇ ਵਿੱਚ ਜਿਵੇਂ ਤਰਨ ਤਰਨ ਸਾਹਿਬ ਆਉਂਦਾ ਹੈ ਅਸੀਂ ਉਥੇ ਵੀ ਦਰਸ਼ਨਾਂ ਲਈ ਰੁਕਣਾ ਹੈ ਉਸ ਤੋਂ ਬਾਅਦ ਅਸੀਂ ਉੱਥੇ ਜਿਵੇਂ ਅੰਮ੍ਰਿਤਸਰ ਸਾਹਿਬ ਜਾਵਾਂਗੇ ਉੱਥੇ ਇੱਕ ਰੂਮ ਜਾਂ ਦੋ ਰੂਮ ਆਪਾਂ ਬੁੱਕ ਵੀ ਕਰਵਾਉਣੇ ਆ ਹੈ ਨਾ ਉਸ ਲਈ ਸਾਨੂੰ ਕੀ ਪੈਕਜ ਦਓਂਗੇ ਕਿੰਨਾ ਖਰਚਾ ਆਏਗਾ ਅਤੇ ਦੂਸਰਾ ਵੀ ਸਾਨੂੰ ਤੁਸੀਂ ਇੱਕ ਗੱਡੀ ਉੱਪਰ ਲੈ ਕੇ ਜਾਓਂਗੇ ਜਾਂ ਦੋ ਗੱਡੀਆਂ ਮੁਹੱਈਆ ਕਰਵਾਓਂਗੇ ਅਤੇ ਕਿੰਨੇ ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਤੁਸੀਂ ਚਾਰਜ ਕਰਦੇ ਓ ਉਹ ਸਾਰੀ ਡਿਟੇਲ ਆਪਾਂ ਨੂੰ ਚਾਹੀਦੀ ਹੈ ਕਿ ਜਿਸ ਕਾਰਨ ਵੀ ਅਸੀਂ ਤੁਹਾਨੂੰ ਦੱਸ ਸਕੀਏ ਕਿ ਸਾਡਾ ਪਲਾਨ ਹੈ ਪੰਜ ਜੂਨ ਨੂੰ ਘਰੋਂ ਆਪਾਂ ਵੀ ਚੱਲੀਏ ਅਤੇ ਉੱਥੇ ਆਪਾਂ ਰਾਤ ਨੂੰ ਪਹੁੰਚ ਕੇ ਅਤੇ ਦੂਸਰੇ ਦਿਨ ਆਪਾਂ ਆਪਾਂ ਦੂਸਰੇ ਦਿਨ ਫਿਰ ਘੁੰਮ ਫਿਰ ਕੇ ਜਿਵੇਂ ਵਾਹਗਾ ਬਾਡਰ ਹੈ ਉਧਰ ਵੀ ਜਾਵਾਂਗੇ ਜ਼ਿਲ੍ਹਿਆਂ ਵਾਲਾ ਬਾਗ ਦੇ ਦਰਸ਼ਨ ਵੀ ਕਰਾਂਗੇ ਅਤੇ ਉਸ ਲਈ ਸਾਨੂੰ ਕਿੰਨਾ ਮਤਲਬ ਤੁਸੀਂ ਚਾਰਜਸ ਕਰੋਗੇ ਕਿੰਨਾ ਖਰਚਾ ਸਾਨੂੰ ਪੇ ਕਰਨਾ ਪਊਗਾ ਅਤੇ ਇੱਕ ਜੋ ਜੋ ਵੀ ਤੁਸੀਂ ਸਾਨੂੰ ਰਸਤੇ ਵਿੱਚ ਸੁਵਿਧਾਵਾਂ ਦਵੋਗੇ ਜਾਂ ਜਿਹੜਾ ਤੁਹਾਡੇ ਨਾਲ ਸਾਡੇ ਨਾਲ ਤੁਸੀਂ ਆਪਣਾ ਡਰਾਈਵਰ ਭੇਜੋਗੇ ਉਹ ਉਸ ਉਸ ਦੀ ਵੀ ਸਾਨੂੰ ਡਿਟੇਲ ਪਹਿਲਾਂ ਮੁਹੱਈਆ ਕਰਵਾਓ ਕਿਉਂਕਿ ਆਪਾਂ ਆਪਣੀ ਪਰਿਵਾਰ ਸਮੇਤ ਜਾਣਾ ਹੈ ਅਤੇ ਉੱਥੇ ਗੁਰੂ ਘਰ ਦੇ ਦਰਸ਼ਨ ਕਰਕੇ ਉੱਥੇ ਸੇਵਾ ਵੀ ਕਰਾਂਗੇ ਅਤੇ ਜੇ ਆਪਣੇ ਕੋਲ ਮਤਲਬ ਸਾਨੂੰ ਤੁਸੀਂ ਇੱਕ ਕੈਬ ਮੁਹੱਈਆ ਕਰਵਾਓਂਗੇ ਜਾਂ ਦੋ ਕੈਬ ਮੁਹੱਈਆ ਕਰਵਾਓਂਗੇ ਉਹ ਸਾਨੂੰ ਉਸ ਚੀਜ਼ ਬਾਰੇ ਵੀ ਸਾਨੂੰ ਦੱਸਿਓ ਅਤੇ ਇਹ ਹੈ ਆਪਣਾ ਪ੍ਰੋਗਰਾਮ ਜਾਣ ਦਾ ਪੰਜ ਜੂਨ ਦਾ ਹੈ ਨਾ ਅਤੇ ਉਧਰੋਂ ਵਾਪਸ ਆਪਾਂ ਆਵਾਂਗੇ ਲਗਭਗ ਲਗਭਗ ਇੱਕ ਹਫ਼ਤੇ ਬਾਅਦ ਤਾਂ ਉਸ ਹਫ਼ਤੇ ਦੇ ਦੌਰਾਨ ਤੁਸੀਂ ਸਾਨੂੰ ਕਿੰਨਾ ਚਾਰਜ ਕਰੋਗੇ ਇੱਕ ਉਹ ਸਾਨੂੰ ਦੱਸ ਦਿਓ ਅਤੇ ਦੂਸਰਾ ਵੀ ਸਾਨੂੰ ਕੀ ਕੀ ਨਾਲ ਦਸਤਾਵੇਜ਼ ਸਾਨੂੰ ਚਾਹੀਦੇ ਹੋਣਗੇ ਜਾਂ ਡਰਾਈਵਰ ਕੋਲ ਆਪਣੇ ਜੋ ਹੈ ਕਾਗਜ਼ ਉਹ ਪੂਰੇ ਹੋਣ ਹੈ ਨਾ ਇਸ ਤਰ੍ਹਾਂ ਦਾ ਸਾਨੂੰ ਡਰਾਈਵਰ ਚਾਹੀਦਾ ਹੋਏਗਾ ਅਤੇ ਆਪਣੇ ਤੁਸੀਂ ਕਿਹੜੀਆਂ ਕਿਹੜੀਆਂ ਸਾਨੂੰ ਕਾਰਾਂ ਮੁਹੱਈਆ ਕਰਵਾ ਸਕਦੇ ਹੋ ਲਾਈਕ ਇਨੋਵਾ ਗੱਡੀ ਕਰਵਾਓਗੇ ਜਾਂ ਕੁਝ ਹੋਰ ਹੈ ਨਾ ਤਾਂ ਉਸ ਚੀਜ਼ ਬਾਰੇ ਸਾਨੂੰ ਇੱਕ ਪੂਰੀ ਸੂਚੀ ਬਣਾ ਕੇ ਸਾਨੂੰ ਭੇਜੋ ਤਾਂ ਕਿ ਆਪਾਂ ਉਹ ਵਾਲਾ ਪ੍ਰੋਗਰਾਮ ਕਰ ਸਕੀਏ